ਹਾਂਜੀ ਮੈਂ ਨਾ ਜ਼ਿਆਦਾਤਰ ਦੋ ਕਲਰ ਦੇ ਨਾ ਸਵੈਟਰ ਬਹੁਤ ਬਣਾਉਂਦੀ ਹਾਂ ਕਿਉਂਕਿ ਉਹ ਜਿਹੜੇ ਦੋ ਰੰਗ ਹੈ ਨਾ ਆਪਸ ਵਿੱਚ ਮਿਲਕੇ ਨਾ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਜ਼ਿਆਦਾਤਰ ਮੈਨੂੰ ਨਾ ਫਿੱਕੇ ਫਿੱਕੇ ਕਲਰ ਬਹੁਤ ਸੋਹਣੇ ਲੱਗਦੇ ਹਨ ਚਾਹੇ ਫਿੱਕਾ ਜਾਂ ਡਾਰਕ ਕੋਈ ਵੀ ਮੈਚ ਕਰ ਲਓ ਜਿਹੜੇ ਦੋ ਰੰਗ ਹੈ ਨਾ ਉਹ ਬਹੁਤ ਵਧੀਆ ਲੱਗਦੇ ਹਨ ਨਾਲੇ ਬੱਚਿਆਂ ਨੂੰ ਬਹੁਤ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਵੀ ਦੋ ਰੰਗਾਂ ਦੇ ਸਵੈਟਰ ਜੱਚਦਾ ਵੀ ਬਹੁਤ ਹੈ ਪਾ ਕੇ ਨਾ ਉਹ ਬਹੁਤ ਵਧੀਆ ਚੱਜਦਾ ਹੈ ਅਤੇ ਮੈਂ ਟੋਪੀ ਬਣਾ ਲਓ ਚਾਹੇ ਕੁਝ ਵੀ ਮਤਲਬ ਦੋ ਰੰਗਾਂ ਦੇ ਹੀ ਬਣਾਓ ਜ਼ਿਆਦਾਤਰ ਉਹ ਬਹੁ ਕਾਲ ਕਾਲੇ ਰੰਗ ਮੇਂ ਤੁਸੀਂ ਵ੍ਹਾਈਟ ਲੈ ਲਿਓ ਚਾ ਬਲੂ ਬਲੂ 'ਚ ਵ੍ਹਾਈਟ ਲੈ ਲਓ ਪਿੰਕ ਵ੍ਹਾਈਟ ਲੈ ਲਓ ਹੈ ਨਾ ਬਹੁਤ ਵਧੀਆ ਲੱਗਦਾ ਹੈ ਗ੍ਰੀਨ 'ਚ ਵ੍ਹਾਈਟ ਲੈ ਲਓ ਮਤਲਬ ਵ੍ਹਾਈਟ ਕਲਰ ਨਾ ਸਾਰਿਆਂ ਵਿੱਚ ਨਾ ਬਹੁਤ ਵਧੀਆ ਬੈਨੀਫਿਟ ਉਹਦਾ ਆਉਂਦਾ ਹੈ ਮਤਲਬ ਉੱਬਰ ਕੇ ਰੰਗ ਆ ਜਾਂਦਾ ਬਾਹਰ ਨੂੰ ਕੋਈ ਵੀ ਦੇਖੇ ਨਾ ਉਹਨੂੰ ਜੱਚ ਜਾਂਦਾ ਹੈ ਵੀ ਬਹੁਤ ਵਧੀਆ ਹੈ ਕਲਰ ਹੈ